ਹਾਂਜੀ ਹਾਂਜੀ ਹੈਲੋ ਹਾਂਜੀ ਹਾਂਜੀ ਗੁਰਮੀਤ ਸਿੰਘ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਮੈਂ ਵੀ ਆਪਣੇ ਬੱਚਿਆਂ ਨੂੰ ਪਾਉਣਾ ਸਕੂਲ 'ਚ ਜੀ ਅਤੇ ਆਪਾਂ ਡਿਸਕਸ਼ਨ ਹੀ ਕਰਨੀ ਸੀ ਉਹ ਤੁਹਾਡੇ ਨਾਲ ਕਰ ਲੈਂਦੇ ਫੋਨ 'ਤੇ ਤੁਹਾਡਾ ਫੋਨ ਆ ਹੀ ਗਿਆ ਅਤੇ ਆਪਾਂ ਕਿਹੜੇ ਸਕੂਲ ਦੇ ਵਿੱਚ ਪਾਈਏ ਜਿਹੜਾ ਕਿ ਆਪਾਂ ਨੂੰ ਫੀਸ ਵੀ ਠੀਕ ਹੋਵੇ ਪੜ੍ਹਾਈ ਵੀ ਵਧੀਆ ਹੋਵੇ ਬੱਚਿਆਂ ਨੂੰ ਉੱਥੇ ਪੜ੍ਹਾਈ ਦਾ ਵਧੀਆ ਮਾਹੌਲ ਵੀ ਮਿਲ ਸਕੇ ਮੈਂ ਜੋ ਸੋਚ ਰਿਹਾ ਮੇਰੇ ਹਿਸਾਬ ਨਾਲ ਤਾਂ ਚੰਡੀਗੜ੍ਹ ਦੇ ਵਿੱਚ ਪਾਇਆ ਜਾਵੇ ਬੱਚਿਆਂ ਨੂੰ ਅਤੇ ਚੰਡੀਗੜ੍ਹ ਦੇ ਨਾਲ ਮੋਹਾਲੀ ਹੈਗਾ ਮੋਹਾਲੀ ਦੇ ਵਿੱਚ ਉਹਦੇ ਵਿੱਚ ਆਪਾਂ ਪਾਇਆ ਜਾਵੇ ਵੀ ਬੱਚਾ ਆਪਣੀ ਮਾਤ ਭਾਸ਼ਾ ਨਾਲ ਜੁੜਿਆ ਰਹੇਗਾ ਅਤੇ ਪੰਜਾਬੀ ਦੇ ਵਿੱਚ ਜਿਹੜਾ ਹੈਗਾ ਬੱਚੇ ਦਾ ਵਧੀਆ ਸਰਵਪੱਖੀ ਵਿਕਾਸ ਹੋਵੇਗਾ ਸਰਕਾਰੀ ਸਕੂਲਾਂ ਦੇ ਵਿੱਚ ਅੱਜ ਕੱਲ੍ਹ ਇੰਨਫਰਾਸਟੱਕਚਰ ਬੜਾ ਵਧੀਆ ਆ ਗਿਆ ਸਰਕਾਰ ਬੜੇ ਧਿਆਨ ਦੇ ਰਹੀ ਹੈਗੀ ਆ ਉਸ ਬੰਨੇ ਅਤੇ ਇੱਕ ਨਵਾਂ ਆਈਡੀਆ ਤੁਹਾਨੂੰ ਮੈਂ ਹੋਰ ਵੀ ਦੱਸਣਾ ਸੀ ਵੀ ਸਾਡੇ ਸਕੂਲਾਂ ਦੇ ਵਿੱਚ ਨਾ ਇੱਕ ਐਨੀਨੈਸ ਨਾਮ ਦਾ ਜਿਹੜਾ ਹੈਗਾ ਉਹ ਸਰਕਾਰ ਸ਼ੁਰੂ ਕਰ ਰਹੀ ਹੈ ਜਿਹਦੇ ਵਿੱਚ ਕਿ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਜਿਹੜਾ ਹੈਗਾ ਨਾ ਉਹਨਾਂ ਦੇ ਵਿੱਚ ਜਿਹੜਾ ਹੈਗਾ ਆ ਉਹ ਵੀ ਇੰਨਫਰਾਸਟੱਕਚਰ ਮਤਲਵ ਕਿ ਪ੍ਰੋਵਾਈਡ ਹੋਵੇਗਾ ਅਤੇ ਬੱਚੇ ਨੂੰ ਵਧੀਆ ਜਿਹੜੀ ਕਿ ਉੱਚ ਨਿਆਲਿਆਂ ਦੀ ਸਿੱਖਿਆ ਦਿੱਤੀ ਜਾਵੇਗੀ ਬਿਲਕੁਲ ਵਾਜਵ ਰੇਟਾਂ 'ਤੇ ਬਿਲਕੁਲ ਸਰਕਾਰ ਦੀ ਫ੍ਰੀ ਔਫ ਕੋਸਟ ਹੈਗੀ ਹੈ ਪਹਿਲੀ ਤੋਂ ਪੰਜਵੀਂ ਤੱਕ ਤਾਂ ਬਿਲਕੁਲ ਫ੍ਰੀ ਹੈਗੀ ਹੈ ਬੱਚਿਆਂ ਨੂੰ ਵਰਦੀ ਦੀ ਵਜ਼ੀ ਵਰਦੀਆਂ ਵੀ ਫ੍ਰੀ ਹੈਗੀਆਂ ਉਸ ਤੋਂ ਬਾਅਦ ਬੱਚਿਆਂ ਨੂੰ ਵਜ਼ੀਫੇ ਵੀ ਹੈਗੇ ਐਗੇ ਹੈ ਅਤੇ ਇਸ ਕਰਕੇ ਆਪਾਂ ਸੋਚੀਏ ਵੀ ਆਪਾਂ ਕਿਉਂ ਨਾ ਆਪਾਂ ਆਪਣੇ ਬੱਚਿਆਂ ਨੂੰ ਆਪਾਂ ਪ੍ਰਾਈਵੇਟ ਸਕੂਲਾਂ ਪੈਸਾ ਲਾਈਏ ਅਤੇ ਬੱਚਿਆਂ ਦੇ ਜਿਹੜੇ ਹੈਗੇ ਉੱਥੇ ਪ੍ਰਾਈਵੇਟ ਸਕੂਲਾਂ ਦੇ ਜਿਹੜਾ ਸਟਾਫ ਹੀ ਹੈਗਾ ਉਹ ਕਾਫੀ ਹੱਦ ਤੱਕ ਹੈਗੇ ਹੈ ਕਿਉਂਕਿ ਉਹ ਇੰਨਾਂ ਕੁਆਲੀਫਾਈਡ ਨਹੀਂ ਹੁੰਦਾ ਕਿਉੰਕਿ ਉਹਨਾਂ ਨੂੰ ਸੈਲਰੀ ਜਿਹੜੀ ਹੈ ਬਹੁਤ ਘੱਟ ਮਿਲਦੀ ਜਿ ਹੈਗੀ ਅਤੇ ਸੈਲਰੀ ਜਿ ਘੱਟ ਮਿਲਣ ਕਰਕੇ ਐਨਾ ਵਧੀਆ ਸਟਾਫ ਜਿਹੜਾ ਹੈਗਾ ਜਦੋਂ ਉਹਨਾਂ ਨੂੰ ਕੋਈ ਨੌਕਰੀ ਮਿਲ ਜਾਂਦੀ ਉਹ ਛੱਡ ਕੇ ਚਲਾ ਜਾਂਦਾ ਹੈ ਅਤੇ ਮੈਂ ਇਹ ਵਿਚਾਰ ਕਰਨਾ ਚਾਹੁੰਦਾ ਸੀ ਵੀ ਜੇ ਆਪਾਂ ਆਪਣੇ ਬੱਚਿਆਂ ਨੂੰ ਆਪਾਂ ਸਰਕਾਰੀ ਸਕੂਲ ਦੇ ਵਿੱਚ ਹੀ ਪੜ੍ਹਨ ਪਾਈਏ ਬਾਕੀ ਤੁਸੀਂ ਦੱਸੋ ਤੁਹਾਡਾ ਕੀ